ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦਾ ਜੀ ਹਾਂਜੀ ਹਾਂਜੀ ਮੈਂ ਤਾਂ ਲੋਂਗੀਆ ਬੋਲਦਾ ਜੀ ਅੱਛਾ ਜੀ ਅੱਛਾ ਅੱਛਾ ਅੱਛਾ ਜੀ ਰਾਮ ਸਿੰਘ ਨੇ ਦਿੱਤਾ ਹੋਣਾ ਨੰਬਰ ਜੀ ਰਾਮ ਸਿੰਘ ਨੇ ਦੱਸਿਆ ਹੋਣਾ ਤੁਹਾਡੇ ਬ੍ਰਦਰ ਨੇ ਅੱਛਾ ਅੱਛਾ ਜੀ ਉਹਦੇ ਬ੍ਰਦਰ ਆ ਤੁਸੀਂ ਅੱਛਾ ਜੀ ਅੱਛਾ ਜੀ ਸਕੂਲ ਤਾਂ ਕਾਫੀ ਹੈ ਜੀ ਇੱਕ ਤਾਂ ਜੀ ਆਪਣਾ ਸਭ ਤੋਂ ਬੈਸਟ ਤਾਂ ਜੀ ਸੈਨਿਕ ਸਕੂਲ ਹੀ ਹੈ ਜੀ ਦੂਜੇ ਨੰਬਰ ਹੋ ਗਿਆ ਜੀ ਐਮ ਜੀ ਐਨ ਅਤੇ ਇਕ ਸ਼ਿਵਾਲਿਕ ਸਕੂਲ ਹੈ ਜੀ ਅਤੇ ਇੱਕ ਹੈਗਾ ਜੀ ਆਪਣਾ ਹੋਲੀ ਕੋਨਵੈਟ ਹੋ ਗਿਆ ਬਾਕੀ ਦਾ ਫਿਰ ਸਰਕਾਰੀ ਸਕੂਲ ਤਾਂ ਹੈਗੇ ਓ ਆ ਜੀ ਦੇਖੋ ਜੀ ਜੇ ਤਾਂ ਆਪਣੇ ਆਪ ਆਪਾਂ ਨੇ ਆਪਣੇ ਬੱਚਿਆਂ ਨੂੰ ਵਧੀਆ ਅਫ਼ੀਸਰ ਲੈਵਲ ਤੱਕ ਲੈ ਕੇ ਜਾਣੇ ਫਿਰ ਤਾਂ ਜੀ ਸੈਨਿਕ ਸਕੂਲ ਬੈਸਟ ਆ ਜੇ ਆਪਾਂ ਇਹਨੂੰ ਆਏ ਆ ਵੀ ਸਾਡੇ ਬੱਚੇ ਥੋੜ੍ਹੇ ਜਿਹੇ ਇੱਧਰ ਆਈ ਟੀ ਊਈਟੀ ਵੱਲ ਧਿਆਨ ਦਵੇ ਨੀਟ ਨੁਟ ਕਨੇ ਪੇਪਰ 'ਚ ਫਿਰ ਤਾਂ ਜੀ ਐਮ ਜੀ ਐਨ ਵਧੀਆ ਉੱਥੇ ਪੜ੍ਹਾਈ ਵਧੀਆ ਇੱਧਰ ਕਨਸਟਰੇਟ ਕਰਾਉਂਦੇ ਗਿਆਰਵੀਂ ਬਾਰਵੀਂ ਦੇ ਬੱਚਿਆਂ ਨੂੰ ਅਤੇ ਬਾਕੀ ਇਹ ਫਿਰ ਆਮ ਥੋੜ੍ਹੇ ਜਿਹੇ ਸਪੋਰਟਸ ਵਾਸਤੇ ਜੀ ਸ਼ਿਵਾਲਿਕ ਸਕੂਲ ਵਧੀਆ ਹੈ ਜੀ ਉੱਥੇ ਕੋਚ ਕੁਚ ਵਧੀਆ ਮਿਲ ਜਾਂਦੇ ਹੈ ਜੀ

ਫਿਰ ਜੀ ਸੈਨਿਕ ਸਕੂਲ ਬੈਸਟ ਹੈ ਜੀ ਉੱਥੇ ਨਾਲੇ ਇੰਨੀਆਂ ਫਸਿਲਟੀਆਂ ਵੀ ਫੁੱਲ ਆ ਜੀ ਬੱਚਿਆਂ ਵਾਸਤੇ ਤਾਂ ਕਿ ਫਿਰ ਫੀਸ ਵੀ ਫੀਸ ਵੀ ਉਹ ਰੇਂਜ ਵਿੱਚ ਆ ਜੀ ਬਾਕੀ ਆਪਾਂ ਪੇ ਕਰ ਸਕਦੇ ਆ ਜੀ ਅਤੇ ਫਿਰ ਰਹਿਣ ਸਹਿਣ ਅੰਦਰ ਹੈ ਜੀ ਡੀ ਬੋਰਡਿੰਗ ਸਕੂਲ ਹੈ ਜੀ ਸੰਡੇ ਆਪਣਾ ਹਾਂਜੀ ਹਾਂਜੀ ਸੰਡੇ ਫਿਰ ਆਪਣਾ ਆ ਜਾਓ ਘਰ ਨੂੰ ਬੱਚੇ ਆ ਜਾਂਦੇ ਸੰਡੇ ਨੂੰ ਆਪਣੇ ਘਰ ਹਾਂ ਹਾਂਜੀ ਐਂਟਰਸ ਹੁੰਦਾ ਜੀ ਇਹ ਆਪਾਂ ਹਰੇਕ ਜਿਕਣਾ ਛੇਵੀਂ ਦਾ ਹੋ ਗਿਆ ਅੱਠਵੀਂ ਦਾ ਹੋ ਗਿਆ ਦਸਵੀਂ ਦਾ ਹੋ ਗਿਆ ਇੱਦਾਂ ਇੱਦਾਂ ਕਰਕੇ

ਹਾਂ ਹਾਂ ਕੋਈ ਗੱਲ ਨਹੀਂ ਜੀ ਮੇਰੇ ਮੇਰੇ ਮੇਰਾ ਬੇਟਾ ਬੇਟੇ ਵੀ ਉਥੇ ਹੀ ਪੜ੍ਹਦੇ ਆ ਜੀ ਆਪਾਂ ਉਹਦੇ ਨਾਲ ਗੱਲ ਕਰਾ ਦਊਂਗੇ ਤੁਹਾਡੇ ਬੱਚਿਆਂ ਦੀ ਥੋੜ੍ਹਾ ਯੂਜ ਟੂ ਹੋ ਜਾਉਂਗੇ ਹਾਂਜੀ ਹਾਂਜੀ ਕਿਹੜੀ ਕਲਾਸ 'ਚ ਲਗਾਉਣੇ ਹੈ ਜੀ ਤੁਸੀਂ ਬੱਚੇ ਕਿਹੜੀ ਕਲਾਸ 'ਚ ਉਹਨਾਂ ਨੇ ਕਰਨਾ ਜੀ ਜੌਇਨ ਹਾਂਜੀ ਹਾਂਜੀ ਇਸ ਵਾਰ ਵੀ ਪੇਪਰ ਹੋਣੇ ਆ ਜੀ ਇਹਦੇ ਇਹਦੇ ਵਾਸਤੇ ਐਂਟਰਨ ਵਾਸਤੇ ਤੁਸੀਂ ਭਰ ਦਿਓ ਮੈਂ ਤੁਹਾਨੂੰ ਸੈਨਿਕ ਸਕੂਲ ਦੀ ਵਟਸਐਪ ਕਰ ਦਊਂਗਾ ਜੀ ਉਹ ਸਕੂਲ ਦੀ ਜਿਹੜੀ ਉਹ ਆ ਵੈਬਸਾਈਡ ਆ ਉਹਦੇ ਉੱਪਰ ਜਾ ਕੇ ਤੁਸੀਂ ਆਪਣਾ ਫਾਰਮ ਫਿਲ ਕਰ ਦਿਓ ਅਤੇ ਫਿਰ ਇੱਕ ਦੋ ਮਹੀਨੇ ਦੇ ਅੰਦਰ ਅੰਦਰ ਹੀ ਪੇਪਰ ਹੁੰਦਾ ਆਪਣੇ ਸਿਲੇਬਸ ਜਿੰਨਾ ਪੜ੍ਹਿਆ ਹੁੰਦਾ ਬੱਚੇ ਨੇ ਉਹਦੇ ਵਿੱਚੋਂ ਪੇਪਰ ਹੋਣਾ ਹੈ ਹਾਂਜੀ ਹਾਂਜੀ ਮੈਂ ਸੁਣਿਆ ਜੀ ਮੈਂ ਪਹਿਲਾਂ ਦਿੱਲੀ ਓ ਰਹਿ ਕੇ ਆਇਆ ਫਿਰ ਮੈਂ ਇੱਧਰ ਮੇਰੀ ਸ਼ਾਦੀ ਹੋ ਗਈ ਸੀ ਫਿਰ ਮੈਂ ਇੱਧਰ ਆ ਗਿਆ ਤਾ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਤੁਸੀਂ ਆਪਣੇ ਬੱਚਿਆਂ ਨੂੰ ਕਹਿ ਦਿਓ ਆਪਣਾ ਫਾਰਮ ਫੁਰਮ ਫਿੱਲ ਕਰ ਦਿਓ ਜੀ ਕਿਉਂਕਿ ਇੱਥੇ ਫਿਰ ਲਿਮਿਟਡ ਸੀਟਾਂ ਹੁੰਦੀਆਂ ਨੇ ਜੀ ਸਕੂਲ 'ਚ ਫਿਰ ਤੁਸੀਂ ਇੱਧਰ ਫਾਰਮ ਵੀ ਨਹੀਂ ਭਰੇ ਹੋਵੇ ਫਿਰ ਤਾਂ ਜੀ ਸ਼ਿਫਾਰਿਸ਼ ਵੀ ਬੜੀ ਤਕੜੀ ਚਾਹੀਦੀ ਉੱਥੇ ਤਾਂ ਆਏਂ ਫਿਰ ਉਹ ਕੁਛ ਕਰਦੇ ਵੀ ਨਹੀਂ ਕਿਉਂਕਿ ਹਰੇਕ ਕਲਾਸ ਬਸ ਚਾਲੀ ਚਾਲੀ ਦੀ ਓ ਕਲਾਸ ਆ ਦੋ ਸੈਕਸ਼ਨ ਹੁੰਦੇ ਆ ਜੀ ਹਾਂਜੀ ਓਕੇ